ਹਾਂਜੀ ਫਲਿੱਪਕਾਡ ਵਾਲਿਓ ਮੈਂ ਲਾਸਟ ਦੇ ਵਿੱਚ ਜਿਹੜਾ ਤੁਹਾਡਾ ਤੁਹਾਡੇ ਤੋਂ ਸਮਾਨ ਮੰਗਾਇਆ ਸੀਗਾ ਜਿਹੜਾ ਕਰੋਕਰੀ ਦਾ ਉਹ ਖਰਾਬ ਹੋ ਗਿਆ ਉਹਦਾ ਰੰਗ ਉੱਤਰ ਗਿਆ ਮੈਨੂੰ ਲੱਗਦਾ ਮੈਂ ਆਪਣੇ ਸਾਰੇ ਪੈਸੇ ਬਰਬਾਦ ਕਰ ਦਿੱਤੇ